ਕੁਝ ਕੁ ਸਮਾਂ ਪਹਿਲਾਂ ਨਾ ਮੈਂ ਮਨਾਲੀ ਗਿਆ ਹੋਇਆ ਸੀਗਾ ਜਿੱਥੇ ਮੈਂ ਟਰੈਕਿੰਗ 'ਤੇ ਗਿਆ ਹੋਇਆ ਸੀ ਟਰੈਕਿੰਗ ਵਿੱਚ ਨਾ ਮੈਂ ਸਾਰਿਆਂ ਆਪਣੇ ਗਰੁੱਪ ਨਾਲੋਂ ਅਲੱਗ ਹੋ ਗਿਆ ਸੀਗਾ ਅਤੇ ਮੈਨੂੰ ਲੱਗਿਆ ਮੈਂ ਉਹਨਾਂ ਸਾਰਿਆਂ ਤੋਂ ਅਲੱਗ ਹੋ ਕੇ ਮਤਲਬ ਮੈਂ ਆਪਣੇ ਆਪ ਨੂੰ ਗਵਾ ਲਿਆ ਅਤੇ ਮੇਰੇ ਕੋਲ ਨਾ ਮ ਐਂਡਰੋਇਡ ਫੋਨ ਸੀਗਾ ਅਤੇ ਮੈਂ ਉਹਦੇ ਵਿੱਚ ਮਤਲਬ ਕਿ ਆਪਣਾ ਜਿਹੜਾ ਮੇਰਾ ਹਾਊਸ ਸੀਗਾ ਉਹ ਹੋਟਲ ਸੀਗਾ ਹੋਟਲ ਦਾ ਮੈਂ ਨਾਮ ਸਰਚ ਕੀਤਾ ਅਤੇ ਮੈਂ ਆਪਣਾ ਹੌਲੀ ਹੌਲੀ ਆਰਾਮ ਨਾਲ ਮਤਲਬ ਕਿ ਹਨੇਰਾ ਹੋ ਗਿਆ ਸੀਗਾ ਅਤੇ ਫੋਨ ਦੀ ਲਾਈਟ ਔਨ ਕਰਕੇ ਮੈਂ ਹੌਲੀ ਹੌਲੀ ਉਹ ਆਪਣਾ ਉਸ ਜਗ੍ਹਾ 'ਤੇ ਪਹੁੰਚ ਗਿਆ ਵੈਸੇ ਗੂਗਲ ਨੇ ਮੈਨੂੰ ਥੋੜ੍ਹਾ ਜਿਹਾ ਗਲਤ ਰਸਤਾ ਵੀ ਦੱਸਿਆ ਅਤੇ ਜਿੱਦਾਂ ਕਿ ਪਿੰਡ ਦੇ ਲੋਕ ਮਿਲਦੇ ਸੀਗੇ ਉੱਥੇ ਘੁੰਮਣ ਆਏ ਹੋਏ ਸੀਗੇ ਜਿਹੜੇ ਲੋਕਲ ਲੋਕ ਸੀਗੇ ਮੈਂ ਉਹਨਾਂ ਤੋਂ ਰਸਤਾ ਪੁੱਛ ਪੁੱਛ ਕੇ ਆਪਣੇ ਹੋਟਲ ਤੱਕ ਪਹੁੰਚ ਗਿਆ ਸੀਗਾ ਜਿੱਦਾਂ ਕਿ ਅਸੀਂ ਨਾ ਜਦੋਂ ਘੁੰਮਣ ਫਿਰਨ ਜਾਣਾ ਹੁੰਦਾ ਉਦੋਂ ਜਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਸਾਨੂੰ ਆਪਣਾ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੇ ਕੋਲ ਪਾਣੀ ਰੱਖਣਾ ਚਾਹੀਦਾ ਅਤੇ ਹੱਥ ਵਿੱਚ ਇੱਕ ਹਰ ਟਾਈਮ ਸਟਿੱਕ ਰੱਖਣੀ ਚਾਹੀਦੀ ਹੈ ਅਤੇ ਆਪਣਾ ਪਿੱਠੂ ਬੈਗ ਹੋਣਾ ਚਾਹੀਦਾ ਜਿਹਦੇ ਵਿੱਚ ਲੋੜੀਂਦੀਆਂ ਚੀਜ਼ਾਂ ਹੋਣ ਜਿਵੇਂ ਖਾਣ ਪੀਣ ਲਈ ਬਹੁਤ ਜ਼ਿਆਦਾ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਸਾਨੂੰ ਜੇ ਅਸੀਂ ਇੱਧਰ ਉੱਧਰ ਹੋ ਜਾਈਏ ਕਿਸੇ ਨਾਲੋਂ ਤਾਂ ਅਸੀਂ ਆਪਣਾ ਖਾ ਪੀ ਕੇ ਇੰਜੋਏ ਕਰ ਸਕੀਏ